ਪੰਜਾਬ ਵਿੱਚ ਸਿਆਸੀ ਪ੍ਰਣਾਲੀ ਅੰਤਰਰਾਸ਼ਟਰੀ ਸਬੰਧਾਂ ਦਾ ਸਾਡੇ ਪੰਜਾਬ ਵਿੱਚ ਬਹੁਤ ਹੀ ਮਹੱਤਵ ਹੈ ਥੋੜ੍ਹੇ ਦਿਨ ਪਹਿਲਾਂ ਹੀ ਬਾਹਰੋਂ ਇੱਥੋਂ ਮੁੰਡਾ ਕੁੜੀ ਨੇ ਵਿਆਹ ਕਰਵਾਇਆ ਸੀ ਅਤੇ ਕੁੜੀ ਬਾਹਰ ਔਸਟ ਕੈਨੇਡਾ ਗਈ ਸੀ ਕੈਨੇਡਾ ਵਿੱਚ ਜਾ ਕੇ ਪਹਿਲਾਂ ਇੱਥੇ ਜਦੋਂ ਕੁੜੀ ਰਹਿੰਦੀ ਸੀ ਪੰਜਾਬ ਵਿੱਚ ਕੁੜੀ ਨੇ ਬਹੁਤ ਵਾਅਦੇ ਕੀਤੇ ਸੀ ਮੁੰਡੇ ਨੂੰ ਕਿ ਮੈਂ ਤੈਨੂੰ ਬਾਹਰ ਲੈ ਕੇ ਜਾਵਾਂਗੀ ਤੂੰ ਮੇਰੇ 'ਤੇ ਪੈਸੇ ਲਗਾ ਮੁੰਡੇ ਨੇ ਸਾਰੇ ਪੈਸੇ ਲਗਾ ਕੇ ਕੁੜੀ ਨੂੰ ਬਾਹਰ ਭੇਜਿਆ ਸੀ ਅਤੇ ਕੁੜੀ ਨੇ ਬਾਹਰ ਜਾ ਕੇ ਉਹਦੇ ਨਾ ਫੋਨ ਚੱਕੇ ਨਾ ਮੈਸਿਜ ਦਾ ਰਿਪਲਾਈ ਕੀਤਾ ਨਾ ਕੁਛ ਕੀਤਾ ਤਾਂ ਫਿਰ ਉਹਨਾਂ ਦੇ ਵਿੱਚ ਗੱਲ ਹੋਣੀ ਬੰਦ ਹੋ ਗਈ ਸੀ ਅਤੇ ਮੁੰਡੇ ਨੂੰ ਬਾਹਰ ਨਹੀਂ ਬੁਲਾ ਰਹੀ ਸੀ ਮੁੰਡਾ ਡਿਪਰੈਸ਼ਨ 'ਚ ਆ ਰਿਹਾ ਸੀ ਪਰ ਮੁੰਡੇ ਨੇ ਆਪਣੇ ਇੱਥੇ ਮਨ ਮਨਿਸਟਰ ਸੀਗੇ ਉਹਨਾਂ ਨੂੰ ਮੇਲ ਪਾਈ ਅਤੇ ਉਹਨਾਂ ਨੇ ਦੇਖਿਆ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਬਾਹਰ ਬਾਹਰ ਲੈਟਰ ਲਿਖ ਕੇ ਭੇਜੀ ਜਸਟਿਨ ਟਰੂਡੋ ਨੂੰ ਕੈਨੇਡਾ ਦੇ ਵਿੱਚ ਕਿ ਇੱਦਾਂ ਇੱਦਾਂ ਗੱਲ ਹੈ ਅਤੇ ਜਸਟਿਨ ਟਰੂਡੋ ਨੇ ਫਿਰ ਉਸ 'ਤੇ ਠੋਸ ਕਦਮ ਚੁੱਕੇ ਅਤੇ ਵਿਆਹੇ ਨਵੇਂ ਵਿਆਹੇ ਜਿਵੇਂ ਕੋਰਟ ਮੈਰਿਜ ਹੋਏ ਬੰਦਿਆਂ ਨੂੰ ਉੱਥੋਂ ਦੀ ਬਾਹਰੋਂ ਦੀ ਬਾਹਰੋਂ ਦੀ ਆਉਣਾ ਬਾਹਰ ਜਾਣ ਲਈ ਮਨਾਹੀ ਕਰ ਦਿੱਤੀ ਥੋੜ੍ਹੀ ਜਿਹੀ